ਤੁਰਿਆ ਨਾ ਜਾਵੇ ਫਿੱਟੇ ਮੂੰਹ ਗੋਡਿਆਂ ਦਾ ਅੱਜ ਕੱਲ੍ਹ ਮੇਰੀ ਲੱਤਾਂ ਤੋਂ ਤਾਂ ਤੁਰਿਆ ਨਹੀਂ ਜਾਂਦਾ ਤਾਂ ਮੈਂ ਕਹਿੰਦੀ ਹਾਂ ਤੁਰਿਆ ਨਾ ਜਾਵੇ ਫਿੱਟੇ ਮੂੰਹ ਗੋਡਿਆਂ ਦਾ ਬੁੱਢੀ ਘੋੜੀ ਲਾਲ ਲਗਾਮ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬੁੱਢੀਆਂ ਵੀ ਲਾਲ ਲਾਲ ਕੱਪੜੇ ਪਾ ਕੇ ਤੁਰਦੀਆਂ ਹਨ ਅਤੇ ਪੇਂਡੂ ਬੁੜੀਆਂ ਉਹਨਾਂ ਨੂੰ ਵੇਖ ਕੇ ਕਹਿੰਦੀਆਂ ਹਨ ਬੁੱਢੀ ਘੋੜੀ ਲਾਲ ਲਗਾਮ ਹੱਥ ਨਾ ਪਹੁੰਚੇ ਥੂ ਕੌੜੀ ਜਦੋਂ ਸਾਡੇ ਤੋਂ ਕੋਈ ਕੰਮ ਨਹੀਂ ਹੁੰਦਾ ਤਾਂ ਅਸੀਂ ਕਹਿੰਦੇ ਆ ਹੱਥ ਨਾ ਪਹੁੰਚੇ ਥੂ ਕੌੜੇ ਚਾਦਰ ਵੇਖ ਕੇ ਪੈਰ ਪਸਾਰਨਾ ਸਿਆਣਿਆਂ ਨੇ ਠੀਕ ਹੀ ਕਿਹਾ ਸਾਨੂੰ ਆਪਣੀ ਚਾਦਰ ਪੈ ਵੇਖ ਕੇ ਹੀ ਪੈਰ ਪਸਾਰਨੇ ਹਨ ਕਿਉਂਕਿ ਅਸੀਂ ਦੂਜਿਆਂ ਵੱਲ ਵੇਖ ਕੇ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਕਿਸੇ ਦਾ ਪੱਕਾ ਵੇਖ ਕੇ ਕੱਚਾ ਨਹੀਂ ਢਾਉਣਾ ਚਾਹੀਦਾ ਸਿਆਣਿਆਂ ਨੇ ਕਿਹਾ ਹੈ ਕਿ ਕਿਸੇ ਦਾ ਪੱਕਾ ਵੇਖ ਕੇ ਸਾਨੂੰ ਕੀ ਆ ਕੱਚਾ ਨਹੀਂ ਢਾਉਣਾ ਚਾਹੀਦਾ ਕਿਉਂਕਿ ਅਸੀਂ ਉਹਨਾਂ ਵੱਲ ਵੇਖ ਕੇ ਨਵੀਂ ਕਾਰ ਖਰੀਦ ਲੈਂਦੇ ਹਾਂ ਪਰ ਸਾਡੀ ਇੰਨੀ ਔਕਾਤ ਨਹੀਂ ਹੁੰਦੀ ਕਿ ਅਸੀਂ ਉਹ ਕਰ ਸਕੀਏ ਉਂਗਲੀ ਕਰਨੀ ਤੋਹਮਤ ਲਾਉਣੀ ਸਾਡੇ ਪੇਂਡੂ ਖੇਤਰ ਵਿੱਚ ਆਮ ਹੀ ਗੱਲ ਹੈ ਉਂਗਲੀ ਕਰਨੀ ਪੁੱਠੀ ਪੌੜੀ ਪੜ੍ਹਾਉਣਾ ਪੁੱਠੇ ਪਾਸੇ ਲਾਉਣਾ ਸਾਡੇ ਪਿੰਡ ਦੇ ਗਲਤ ਮੁੰਡਿਆਂ ਨੇ ਚੰਗੇ ਮੁੰਡਿਆਂ ਨੂੰ ਵੀ ਪੁੱਠੀ ਪੱਟੀ ਪੜ੍ਹਾਉਂਦੇ ਹਨ ਆਈ ਚਲਾਈ ਕਰਨੀ ਜਿੰਨੀ ਕਮਾਈ ਉੰਨਾ ਖਰਚਾ ਮਹਿੰਗਾਈ ਕਾਰਨ ਅੱਜ ਕੱਲ੍ਹ ਸਾਰੇ ਘਰਾਂ ਦਾ ਮਸਾਂ ਆਈ ਚਲਾਈ ਹੁੰਦੀ ਹੈ ਸਾਹ ਵਿੱਚ ਸਾਹ ਆਉਣੇ ਮੁਸੀਬਤ ਵਿੱਚੋਂ ਨਿਕਲਣਾ ਕਿ ਸਧਾਰਨ ਅਵਸਥਾ ਵਿੱਚ ਹੋਣਾ ਜਦੋਂ ਮੈਂ ਪੁਲਿਸ ਨੂੰ ਵੇਖਿਆ ਤਾਂ ਮੈਂ ਡਰ ਗਈ ਕਿਉਂਕਿ ਮੇਰੇ ਕੋਲ ਲਾਈਸੰਸ ਨਹੀਂ ਸੀ ਜਦੋਂ ਮੈਂ ਨਾਕੇ ਤੋਂ ਅੱਗੇ ਨਿਕਲ ਗਈ ਤਾਂ ਮੇਰੇ ਸਾਹ ਵਿੱਚ ਸਾਹ ਆ ਗਏ